ਚੌਦਾਂ ਜਨਵਰੀ ਦੋ ਹਜ਼ਾਰ ਦੋ ਪੰਦਰਾਂ ਫਰਵਰੀ ਦੋ ਹਜ਼ਾਰ ਦਸ ਇੱਕੀ ਜੂਨ ਦੋ ਹਜ਼ਾਰ ਨੌ ਪੰਦਰਾਂ ਅਪ੍ਰੈਲ ਦੋ ਹਜ਼ਾਰ ਇੱਕ ਚੌਦਾਂ ਫਰਵਰੀ ਦੋ ਹਜ਼ਾਰ ਨੌ